ਮੇਰਾ ਮੰਨਣਾ ਇਹ ਹੈ ਕਿ ਸਾਨੂੰ ਸਾਫ਼ ਸੁਥਰੇ ਮਤਲਬ ਵਾਤਾਵਰਨ ਵਿੱਚ ਰਹਿਣਾ ਚਾਹੀਦਾ ਹੈ ਜੇਕਰ ਜਿੰਨਾ ਹੀ ਅਸੀਂ ਸਾਫ਼ ਸੁਥਰਾ ਵਾਤਾਵਰਨ ਵਿੱਚ ਰਮਾ ਵਾਤਾਵਰਨ ਵਿੱਚ ਰਹਾਂਗੇ ਉੰਨਾ ਹੀ ਅਸੀਂ ਸਾਫ਼ ਸੁਥਰਾ ਜੀਵਨ ਬਤੀਤ ਕਰ ਸਕਦੇ ਹਾਂ ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਜੇਕਰ ਅਸੀਂ ਸਾਫ਼ ਸੁਥਰ ਵਾਤਾਵਰਨ 'ਚ ਰਹਾਂਗੇ ਤਾਂ ਸਾਨੂੰ ਗੰਦਗੀ ਮਹਿਸੂਸ ਨਹੀਂ ਹੋਵੇਗੀ ਨਾ ਹੀ ਸਾਨੂੰ ਕੋਈ ਚਿੜਚਿੜਾਪਨ ਮਹਿਸੂਸ ਹੋਵੇਗਾ ਸਾਫ਼ ਸੁਥਰਾ ਵਾਤਾਵਰਨ ਵਿੱਚ ਹੀ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ ਇਸ ਇਹ ਸਾਨੂੰ ਮੇਰੀ ਮਤਲਬ ਮੰਨਣਾ ਇਹ ਹੈ ਕਿ ਮੇਰੀ ਮੰਮਾ ਕਹਿੰਦੇ ਹੈ ਵੀ ਜੇਕਰ ਤੂੰ ਘਰ ਦਾ ਕੰਮ ਨਹੀਂ ਕਰ ਸਕਦੀ ਤਾਂ ਤੁਸੀਂ ਬਾਹਰ ਦਾ ਹੈ ਨਾ ਮਤਲਬ ਕੋਲਜ ਅ ਜਾਣਾ ਤੁਸੀਂ ਨੇ ਤਾਂ ਤੁਸੀਂ ਘਰ ਵਿੱਚ ਹੀ ਬਹਿ ਕੇ ਮਤਲਬ ਸਫ਼ਾਈ ਨਹੀਂ ਕਰ ਸਕਦੇ ਤਾਂ ਆਪਾਂ ਕੰਮ ਵਾਲੀ ਲਾ ਲਾਂਗੇ ਮੈਨੂੰ ਇਸ ਇਹ ਗੱਲ ਸੁਣਕੇ ਬਹੁਤ ਗੁੱਸਾ ਆਇਆ ਕਿਉਂਕਿ ਮੈਨੂੰ ਕਿਸੇ ਦੇ ਹੱਥ ਦਾ ਕੰਮ ਕਰਨਾ ਪਸੰਦ ਨਹੀਂ ਹੈ ਜੋ ਕਿ ਮਤਲਬ ਮੈਨੂੰ ਕਿਸੇ ਦਾ ਹੱਥ ਪਸੰਦ ਕੰਮ ਨਹੀਂ ਹੈ ਕਿਉਂਕਿ ਮੈਨੂੰ ਆਪਣੇ ਹੱਥ ਕੰਮ ਪਸੰਦ ਹੈ ਮੈਨੂੰ ਮਤਲਬ ਭਾਵ ਘਰਾਂ ਨੂੰ ਕਿਸ ਤਰ੍ਹਾਂ ਧੋਣਾ ਚਾਹੀਦਾ ਹੈ ਘਰ ਨੂੰ ਮਤਲਬ ਜੇਕਰ ਇਹੇ ਜਿਹਾ ਅਜਿਹੀ ਜਗ੍ਹਾ ਵਿੱਚ ਕੂੜਾ ਕਰਕਟ ਜੰਮਿਆ ਜਾਂਦਾ ਜਿੱਥੇ ਅਸੀਂ ਉਸਨੂੰ ਸਾਫ਼ ਸੁਥਰਾ ਨਹੀਂ ਕਰ ਸਕਦੇ ਅਤੇ ਉੱਥੇ ਪਾਣੀ ਮਾਰ ਕੇ ਵੈਪਰ ਨੂੰ ਮਤਲਬ ਵੈਪਰ ਨਾਲ ਕੱਢ ਕੇ ਉਸਨੂੰ ਧੋਤਾ ਜਾਂਦਾ ਹੈ ਜਿਸ ਨਾਲ ਉਹ ਅਸਾਨੀ ਨਾਲ ਸਾਫ਼ ਹੋ ਉਹ ਅਜਿਹ ਅਜਿਹੀ ਥਾਂ 'ਤੇ ਮੱਛਰ ਨਹੀਂ ਬੈਠਦਾ ਅਤੇ ਉਸ ਪਾਣੀ ਨੂੰ ਅਰਾਮ ਨਾਲ ਖਿੱਚ ਸਕਦੇ ਹਾਂ ਮਤਲਬ ਉਸਨੂੰ ਹੂੰਝ ਸਕਦੇ ਹਾਂ ਪਾਣੀ ਨੂੰ ਮਤਲਬ ਅਸੀਂ ਇਕੱਠਾ ਨਹੀਂ ਰਹਿ ਦੇ ਸਕਦੇ ਕਿਉਂਕਿ ਉਸ ਨਾਲ ਬਿਮਾਰੀਆਂ ਫੈਲ ਸਕਦੀਆਂ ਜੇਕਰ ਮੱਛਰ ਆਉਣਗੇ ਤਾਂ ਬਿਮਾਰੀਆਂ ਪੈਣਗੀਆਂ ਅਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਣਗੀਆਂ ਇਸ ਲਈ ਸਾਨੂੰ ਆਪਣੇ ਘਰਾਂ ਵਿੱਚ ਸਾਫ਼ ਸੁਥਰੇ ਢੰਗ ਨਾਲ ਮਤਲਬ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਮਤਲਬ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਮਤਲਬ ਆਪਣੇ ਘਰਾਂ ਨੂੰ ਅਸੀਂ ਇੱਕ ਸੁਰਕਸ਼ਾ ਕ ਸੁਰੱਖਿਅਤ ਥਾਂ ਬਣਾਉਣਾ ਚਾਹੁੰਦੇ ਹਾਂ ਹਰੇਕ ਆ ਆਦਮੀ ਮਤਲਬ ਔਰਤ ਇਹ ਚਾਹੁੰਦੇ ਹਨ ਕਿ ਸਾਡਾ ਘਰ ਸਾਫ਼ ਸੁਥਰਾ ਹੋਵੇ ਅਤੇ ਉਸਨੂੰ ਅਸੀਂ ਵਧੀਆ ਢੰਗ ਨਾਲ ਜੀਵਨ ਬਤੀਤ ਕਰ ਸਕਦੇ ਹਾਂ ਗਊ ਡੰਕ ਦੀ ਵਰਤੋਂ ਗਊ ਡੰਕ ਦੀ ਵਰਤੋਂ ਮਤਲਬ ਅਸੀਂ ਘਰਾਂ ਨੂੰ ਘਰਾਂ ਵਿੱਚ ਗਊ ਡੰਕ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਕਰਕੇ ਪੁਰਾਣੇ ਜਮਾਨੇ ਵਿੱਚ ਇਹ ਗਊ ਡੰਕ ਦੀ ਵਰਤੋਂ ਕੀਤੀ ਜਾਂਦੀ ਲੋਕ ਤਿੱਥ ਤਿਉਹਾਰਾਂ ਵਿੱਚ ਇਸਨੂੰ ਤਿੱਥ ਤਿਉਹਾਰਾਂ ਵਿੱਚ ਇਸਨੂੰ ਮਤਲਬ ਆਮ ਤੌਰ 'ਤੇ ਵਰਤਦੇ ਸਨ ਜੋ ਕਿ ਜੋ ਕਿ ਸਾਡੇ ਸਮਾਜ ਵਿੱਚ ਅੱਜ ਕੱਲ੍ਹ ਨਵੀਂ ਪੀੜ੍ਹੀ ਦੇ ਹੋਣ ਕਰਕੇ ਨਹੀਂ ਸੀ ਵਰਤਿਆ ਜਾ ਸਕਦਾ ਹੈ ਕਿ ਪੁਰਾਣੀ ਨਵੀਂ ਪੀੜ੍ਹੀ ਦੇ ਲੋਕ ਜ਼ਿਆਦਾਤਰ ਤਾਂ ਕੀ ਗਊ ਡੰਕ ਦੀ ਵਰਤੋਂ ਨਹੀਂ ਕਰਦੇ ਉਸਨੂੰ ਗੰਦਾ ਸਮਝਦੇ ਹਨ ਅਤੇ ਗੰਦਗੀ ਮਹਿਸੂਸ ਕਰਦੇ ਹਨ ਮਤਲਬ ਇਸ ਤੋਂ ਬ ਬੜੀ ਹੀ ਖਿਝ ਆਉਂਦੀ ਹੈ ਪੁਰਾਣੀਆਂ ਔਰਤਾਂ ਆਪਣੇ ਘਰਾਂ ਵਿੱਚ ਕਈ ਦਿਨਾਂ ਤੋਂ ਹੀ ਤਿਉਹਾਰ ਮੇਲੇ ਤਿਉਹਾਰਾਂ ਵਿੱਚ ਆਪਣੇ ਮਤਲਬ ਉਹ ਕਰ ਦਿੰਦੀਆਂ ਸਨ ਸਾਫ਼ ਸਫਾਈ ਕਰ ਦਿੰਦੀਆਂ ਸਨ ਔਰ ਮਤਲਬ ਕਈ ਦਿਨਾਂ ਤੋਂ ਹੀ ਮਿੱਟੀ ਪੋਚਾ ਕਰਨ ਲੱਗ ਜਾਂਦੀਆਂ ਸਨ ਅਤੇ ਝਾੜੂ ਨੂੰ ਅ ਮਾਰ ਸਕਦੇ ਸਨ ਉਹ ਅਤੇ ਇਸ ਤਰ੍ਹਾਂ ਹੀ ਅਸੀਂ ਕਈ ਦਿਨਾਂ ਤੋਂ ਹੀ ਮੇਲਿਆਂ ਅਤੇ ਤਿਉਹਾਰਾਂ ਦੀਆਂ ਤਿਆਰੀਆਂ ਚੱਲਣ ਲੱਗ ਜਾਂਦੀਆਂ ਅਤੇ ਉਸਨੂੰ ਰੰਗੋਲੀ ਵੀ ਬਣਾ ਸਕਦੇ ਹਾਂ ਅਸੀਂ ਪੁਰਾਣੇ ਸਮੇਂ ਵਿੱਚ ਇਸ ਲਈ ਸਾਡੇ ਸਮਾਜ ਵਿੱਚ ਮਤਲਬ ਗਊ ਡੰਕ ਦੀ ਵਰਤੋਂ ਅਸਾਨੀ ਨਾਲ ਕੀਤੀ ਜਾ ਸਕਦੀ ਗਊ ਡੰਕ ਦੀ ਜਗ੍ਹਾ 'ਤੇ ਜਿਹਨ ਅਸੀਂ ਉਸਨੂੰ ਸੁੱਕਾ ਕੂੜਾ ਅਲੱਗ ਕਰਦੇ ਹਾਂ ਅਤੇ ਗਿੱਲਾ ਕੂੜਾ ਅਲੱਗ ਕਰਦੇ ਹਾਂ ਗਊ ਗਊ ਦਾ ਜਿਹੜਾ ਗੋਬਰ ਹੁੰਦਾ ਗਾ ਉਸਨੂੰ ਅਸੀਂ ਪਾਥੀਆਂ ਪੱਥਦੇ ਹਾਂ ਅਤੇ ਚੁੱਲ੍ਹੇ ਵਿੱਚ ਆਮ ਤੌਰ 'ਤੇ ਵਰਤ ਸਕਦੇ ਹਾਂ ਇਸ ਲਈ ਸਾਨੂੰ ਆਮ ਤੌਰ 'ਤੇ ਗਊਆਂ ਦੇ ਗੋਬਰ ਨੂੰ ਚੰਗੀ ਤਰ੍ਹਾਂ ਵਰਤਿਆ ਜਾ ਸਕਦਾ ਹੈ ਇਸ ਲਈ ਸਾਨੂੰ ਗਊ ਡੰਕ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਸਾਡੇ ਲਈ ਬਹੁਤ ਲਾਭਦਾਇਕ ਹੈ ਅਤੇ ਸਿਹਤ ਨੂੰ ਚੰਗੀ ਤਰ੍ਹਾਂ ਬਣਾਉਣਾ ਚਾਹੀਦਾ ਹੈ